ਭਾਰਤ ਸਰਕਾਰ ਨੇ ਅਸਾਮ ਦੇ ਨਾਗਰਿਕਾਂ ਦੇ ਲਈ ਇੱਕ ਅੰਮ੍ਰਿਤ ਅਟਲ ਅੰਮ੍ਰਿਤ ਅਭਿਆਨ ਦੇ ਨਾਮ ਨਾਲ ਇੱਕ ਕੈਸ਼ਲੈਸ ਸਿਹਤ ਸੇਵਾ ਯੋਜਨਾ ਸ਼ੁਰੂ ਕੀਤੀ ਹੈ ਇਹ ਯੋਜਨਾ ਅਸਾਮ ਦੇ ਲੋਕਾਂ ਦੀ ਭਲਾਈ ਦੇ ਲਈ ਸ਼ੁਰੂ ਕੀ ਕੀਤੀ ਹੈ ਅਤੇ ਉਹਨਾਂ ਦੇ ਸੁਧਾਰ ਲਈ ਇੱਕ ਪਹਿਲ ਹੈ ਜਿਨ੍ਹਾਂ ਲੋਕਾਂ ਦੀ ਸਲਾਨਾ ਆਮਦਨ ਪੰਜ ਲੱਖ ਤੋਂ ਘੱਟ ਹੈ ਉਹ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਇਸ ਯੋਜਨਾ ਦਾ ਉਦੇਸ਼ ਇਹ ਸੀ ਕਿ ਸਰਕਾਰ ਲੋਕਾਂ ਨੂੰ ਪੰਜ ਸੌ ਰੁਪਏ ਤੱਕ ਦਾ ਮੁਫਤ ਅਤੇ ਕੈਸ਼ਲੈਸ ਇਨ੍ਹਾਂ ਨੂੰ ਇਲਾਜ ਦੇ ਸਕਦੀ ਸੀ ਜਿਹਦੇ ਨਾਲ ਉਹ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਦੇ ਸੀ ਅਤੇ ਸਰਕਾਰ ਵੀ ਉਹਨਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਕਦਮ ਉਠਾ ਰਹੀ ਹੈ ਹਰ ਸਾਲ ਦੋ ਲੱਖ ਰੁਪਇਆ ਦੇ ਕੇ ਇਸ ਯੋਜਨਾ ਦੇ ਇਹ ਇਹ ਲਾਭ ਹਨ ਕਿ ਜਿਹੜੇ ਲੋਕੀਂ ਉਹ ਜਿਹੜੇ ਕੈਸ਼ਲੈਸ ਆਪਣੀ ਕੈਸ਼ਲੈੱਸ ਫਸਟ ਦੇਖਭਾਲ ਕਰਾ ਸਕਦੇ ਅਤੇ ਇਲਾਜ ਕਰਵਾ ਸਕਦੇ ਦੋ ਲੱਖ ਤੱਕ ਫਰੀ ਇਲਾਜ ਕਰਾ ਸਕਦੇ ਕੈਂਸਰ ਗੁਰਦੇ ਦੀ ਬਿਮਾਰੀ ਤਾਂਤਰਿਤ ਸੰਬੰਧੀ ਸਿੱਧੀਆਂ ਨਵਜਾਤ ਜਿਹੜੇ ਬੱਚੇ ਹੈ ਉਹਨਾਂ ਦੀ ਬਿਮਾਰੀਆਂ ਜਲਣ ਹੋ ਗਈ ਹਿਰਦੇ 'ਚ ਮਤਲਬ ਦਿਲ ਵਿੱਚ ਜੋ ਬਿਮਾਰੀਆਂ ਉਹਨਾਂ ਨੂੰ ਉਹਨਾਂ ਦੇ ਇਲਾਜ ਲਈ ਪੈਸ ਹੈਲਪ ਲੈ ਸਕਦੀ ਹੈ ਇਲਾਜ ਕਰਵਾਉਣ ਕਰਵਾਉਣ ਵਾਲੇ ਮਰੀਜ਼ ਹੈ ਜਿਹੜੇ ਬਿਨਾਂ ਕਿਸੇ ਭੁਗਤਾਨ ਦੇ ਲਈ ਭਰਤ ਲਈ ਭਰਤੀ ਕੀਤੇ ਜਾ ਸਕਦੇ ਹਨ ਉਪਚਾਰ ਵਿੱਚ ਦਵਾਈ ਭੋਜਨ ਔਰ ਜਿਹੜਾ ਹੋਸਪਿਟਲ ਦਾ ਖਰਚਾ ਏ ਉਹ ਵੀ ਹੋਸਪਿਟਲ ਦਾ ਸਰਕਾਰ ਹੀ ਦਿੰਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਮਿਲਣ ਦਾ ਜਿਹੜਾ ਯਾਤਰਾ ਖਰਚਾ ਇਲਾਜ ਹੈ ਦੈਨਿਕ ਭੱਤਾ ਏ ਉਹ ਵੀ ਯੋਜਨਾ ਦੇ ਵਿੱਚ ਸ਼ਾਮਿਲ ਹੈ ਅਤੇ ਮੈਂ ਇਸ ਸਕੀਮ ਦਾ ਕਦੀ ਫਾਇਦਾ ਨਹੀਂ ਲਿਆ ਅਤੇ ਮੈਂ ਨਾ ਮੇਰੇ ਕਿਸੇ ਜਾਣ ਪਛਾਣ ਦੇ ਨੇ ਲਿਆ ਅਤੇ ਮੈਂ ਇਹੀ ਕਹੂੰਗੀ ਕਿ ਜਿਹੜੇ ਲੋਕੀਂ ਅਸਾਮ ਦੇ ਨੇ ਉਹ ਤਾਂ ਇਸ ਸਕੀਮ ਦਾ ਜ਼ਰੂਰ ਫਾਇਦਾ ਲੈ ਸਕਣ ਤਾਂ ਆਪਣੀ ਆਪਣੀ ਸਿਹਤ ਦਾ ਧਿਆਨ ਰੱਖਣ